ਜਿਵੇਂ ਆਪਾਂ ਜਾਣਦੇ ਹੀ ਹਾਂ ਕਿ ਜਦੋਂ ਆਪਣੇ ਕੋਲ ਸਮਾਂ ਜਾਂ ਸਮੱਗਰੀ ਘੱਟ ਹੋਵੇ ਤਾਂ ਆਪਾਂ ਕਈ ਤਰ੍ਹਾਂ ਦੇ ਹਲਕੇ ਫੁਲਕੇ ਭੋਜਨ ਤਿਆਰ ਕਰ ਸਕਦੇ ਹਾਂ ਜਿਵੇਂ ਕਿ ਮੈਨੂੰ ਮੈਗੀ ਖਾਣਾ ਬੜੀ ਪਸੰਦ ਆ ਹੋਰ ਇਸ ਤਰ੍ਹਾਂ ਦੇ ਕਈ ਭੋਜਨ ਆ ਜਿਵੇਂ ਕੜਾਹ ਕੜਾਹ ਦੇ ਵਿੱਚ ਸਿਰਫ਼ ਆਪਾਂ ਪਾਣੀ ਲੈਣਾ ਆ ਰਵਾ ਹੋਣਾ ਚਾਹੀਦਾ ਥੋੜ੍ਹਾ ਜਿਹਾ ਅਤੇ ਬਸ ਖੰਡ ਅਤੇ ਘਿਓ ਇਹਦੇ ਵਿੱਚ ਬਹੁਤ ਹੀ ਘੱਟ ਸਮਗਰੀ ਲੱਗਦੀ ਹੈ ਅਤੇ ਸਮਾਂ ਹੀ ਬਹੁਤ ਘੱਟ ਲੱਗਦਾ ਹੈ ਇਹ ਚੀਜ਼ ਬਣ ਕੇ ਜਲਦੀ ਹੀ ਤਿਆਰ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਵੇਂ ਮੈਗੀ ਮੈਗੀ ਜੋ ਕਿ ਸਿਰਫ਼ ਆਪਾਂ ਨੂੰ ਇੱਕ ਦਸ ਰੁਪਏ ਦਾ ਪੈਕਿਟ ਇਹਦੇ 'ਤੇ ਪੈਸਾ ਵੀ ਬਹੁਤ ਘੱਟ ਲੱਗਦਾ ਹੈ ਜਿੱਦਾਂ ਪੈਕਿਟ ਦਸ ਰੁਪਏ ਦਾ ਲੈ ਕੇ ਆਪਾਂ ਇਸ ਨੂੰ ਤ ਪਿਆਜ਼ ਲਿਆ ਇੱਕ ਆਲੂ ਲਿਆ ਇੱਕ ਪਿਆਜ਼ ਅਤੇ ਇੱਕ ਆਲੂ ਦੇ ਨਾਲ ਹੀ ਇਸ ਨੂੰ ਵਧੀਆ ਤਰ੍ਹਾਂ ਨਾਲ ਬਣਾ ਸਕਦੇ ਹਾਂ ਇਹਨਾਂ ਨੂੰ ਕੱਟ ਕੇ ਆਪਾਂ ਥੋੜ੍ਹਾ ਜਿਹਾ ਫਰਾਈ ਕਰਕੇ ਅਤੇ ਇਸ ਵਿੱਚ ਮੈਗੀ ਪਾ ਕੇ ਪਾਣੀ ਪਾ ਕੇ ਇਹਨੂੰ ਦਸ ਪੰਦਰਾਂ ਮਿੰਟ ਦੇ ਵਿੱਚ ਤਿਆਰ ਕਰ ਸਕਦੇ ਹਾਂ ਬਹੁਤ ਹੀ ਘੱਟ ਸਮੇਂ ਵਿੱਚ ਇਹ ਚੀਜ਼ਾਂ ਤਿਆਰ ਹੋ ਜਾਂਦੀਆਂ ਹਨ ਜਦੋਂ ਮੇਰੇ ਕੋਲ ਸਮਾਂ ਘੱਟ ਹੋਵੇ ਤਾਂ ਮੈਂ ਮੈਗੀ ਜਾਂ ਕੜਾਹ ਪੋਹਾ ਆਦਿ ਚੀਜ਼ਾਂ ਬਣਾਉਂਦੀ ਹਾਂ